ਮੈਂ ਇੱਕ ਕਿਤਾਬ ਪੜ੍ਹੀ ਸੀ ਜਿਹੜੀ ਤਾਂ ਮੈਨੂੰ ਪਹਿਲਾਂ ਤਾਂ ਪਸੰਦ ਨਹੀਂ ਆਈ ਸੀ ਪਰ ਜਦੋਂ ਮੈਂ ਪੜ੍ਹੀ ਅਤੇ ਉਸ ਵਿੱਚ ਮੈਨੂੰ ਇੰਟਰਸਟ ਬਣਿਆ ਇਹ ਕਿਤਾਬ ਮੈਨੂੰ ਮੇਰੀ ਇੱਕ ਫਰੈਂਡ ਨੇ ਸੁਜੈਸਟ ਕੀਤੀ ਸੀ ਉਸਨੇ ਮੈਨੂੰ ਕਿਹਾ ਸੀ ਇਹ ਕਿਤਾਬ ਤੁਸੀਂ ਪੜ੍ਹੋ ਪਰ ਮੈਨੂੰ ਇਹ ਕਿਤਾਬ ਪਹਿਲਾਂ ਤਾਂ ਦੇਖਣ ਵਿੱਚ ਚੰਗੀ ਨਹੀਂ ਲੱਗੀ ਥੋੜ੍ਹੀ ਜਿਹੀ ਸਟੋਰੀ ਵੀ ਇਸ ਦੀ ਮੈਨੂੰ ਪਸੰਦ ਨਹੀਂ ਆਈ ਪਰ ਜਦੋਂ ਮੈਂ ਇਹਨੂੰ ਹੌਲੀ ਹੌਲੀ ਪੜ੍ਹਨਾ ਸ਼ੁਰੂ ਕੀਤਾ ਮੈਨੂੰ ਇਹਦੇ ਵਿੱਚ ਇੰਟਰਸਟ ਬਣਨਾ ਸ਼ੁਰੂ ਹੋਇਆ ਇਹ ਕਿਤਾਬ ਵਿਚ ਵੱਡ ਵਡੇਰਿਆਂ ਬਾਰੇ ਥੋੜ੍ਹਾ ਪਰਿਵਾਰ ਬਾਰੇ ਦੱਸਿਆ ਗਿਆ ਸੀ ਜਿਸ ਵਿੱਚ ਕਿ ਕਿੱਦਾਂ ਰਹਿਣਾ ਸਹਿਣਾ ਕੀ ਅਸੀਂ ਆਪਣੇ ਪਰਿਵਾਰ ਨੂੰ ਜੋੜੇ ਰੱਖਣ ਵਾਸਤੇ ਕਰ ਸਕਦੇ ਹਾਂ ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਵੈਸੇ ਬਹੁਤ ਘੱਟ ਚੁੱਕਿਆ ਹੈ ਪਰ ਫਿਰ ਵੀ ਪਰਿਵਾਰ ਨਾਲ ਪਿਆਰ ਪਰਿਵਾਰ ਦਾ ਰਹਿਣ ਸਹਿਣ ਸਭ ਕੁਛ ਉਸ ਕਿਤਾਬ ਵਿੱਚ ਦੱਸਿਆ ਗਿਆ ਸੀ ਮੈਨੂੰ ਕਿਤਾਬ ਪੜ੍ਹ ਕੇ ਬੜਾ ਚੰਗਾ ਲੱਗਾ ਮੇਰਾ ਬੜਾ ਇੰਟਰਸਟ ਬਣਿਆ ਤਾਂ ਜੋ ਕਿ ਉਹ ਕਿਤਾਬ ਨੂੰ ਮੈਂ ਇੱਕ ਦੋ ਵਾਰੀ ਪੜ੍ਹਿਆ ਫਿਰ ਮੈਨੂੰ ਜਾ ਕੇ ਪਤਾ ਲੱਗਾ ਕਿ ਇਸ ਕਿਤਾਬ ਵਿੱਚ ਕਈ ਮਹੱਤਵਪੂਰਨ ਇਹੋ ਜਿਹੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਸਮਝਣ ਦੀ ਆਪਣੇ ਜੀਵਨ ਵਿੱਚ ਬੜੀ ਲੋੜ ਹੈ ਮੈਂ ਉਸ ਕਿਤਾਬ ਨੂੰ ਦੋ ਤਿੰਨ ਵਾਰੀ ਪੜ੍ਹਿਆ ਤਾਂ ਜੋ ਕਿ ਮੇਰਾ ਇੰਟਰਸਟ ਬਣਿਆ ਮੈਨੂੰ ਬਹੁਤ ਪਸੰਦ ਆਈ ਫਿਰ ਮੈਂ ਆਪਣੇ ਇੱਕ ਦੋ ਫਰੈਂਡਸ ਨੂੰ ਹੋਰ ਦੱਸਿਆ ਇਸ ਕਿਤਾਬ ਬਾਰੇ ਤਾਂ ਜੋ ਕਿ ਉਹ ਵੀ ਇਸ ਕਿਤਾਬ ਨੂੰ ਪੜ੍ਹਨ ਅਤੇ ਉਹਨਾਂ ਦਾ ਵੀ ਇੰਟਰਸਟ ਬਣੇ ਮੈਨੂੰ ਤਾਂ ਇਹ ਕਿਤਾਬ ਬਹੁਤ ਚੰਗੀ ਲੱਗੀ ਬਾਕੀ ਇਹਨਾਂ ਦੇ ਪੜ੍ਹਨ ਨਾਲ ਉਹਨਾਂ ਨੂੰ ਸਮਝਣ ਨਾਲ ਉਹਨਾਂ ਨੂੰ ਪਤਾ ਲੱਗੇਗਾ ਕਿ ਇਸ ਕਿਤਾਬ ਵਿੱਚ ਇਹੋ ਜਿਹੀਆਂ ਮਹੱਤਵਪੂਰਨ ਚੀਜ਼ਾਂ ਹਨ ਜੋ ਕਿ ਤੁਸੀਂ ਪੜ੍ਹੋ ਅਤੇ ਤੁਹਾਨੂੰ ਇੰਟਰਸਟ ਬਣੇ ਬਾਕੀ ਉਸ ਕਿਤਾਬ ਬਾਰੇ ਜਿੰਨੀ ਤਾਰੀਫ ਕੀਤੀ ਜਾਏ ਉੱਨੀ ਥੋੜ੍ਹੀ ਹੈ ਸੋ ਧੰਨਵਾਦ